ਇੱਕ ਸਿੱਖਿਅਤ ਵਿਅਕਤੀ ਹੋਣਾ ਬਹੁਤ ਚੰਗੀ ਗੱਲ ਹੈ ਪਰ ਸਿੱਖਿਅਤ ਵਿਅਕਤੀ ਦੇ ਵਿੱਚ ਬਹੁਤ ਸਾਰੇ ਵਿਵਹਾਰ ਗੁਣ ਸਿਧਾਂਤ ਹੁੰਦੇ ਨੇ ਅਤੇ ਉਹ ਪਾਲਣਾ ਆਪ ਵੀ ਕਰਦਾ ਅਤੇ ਦੂਜਿਆਂ ਨੂੰ ਵੀ ਕਰਾਉਂਦਾ ਜਿੱਦਾਂ ਕਿ ਉਸਦੇ ਬੋਲਣ ਦਾ ਸਹੀ ਤਰੀਕਾ ਦੂਜੇ ਬੰਦੇ ਨਾਲ ਗੱਲਬਾਤ ਕਰਨ ਦਾ ਡੀਲਿੰਗ ਕਰਨ ਦਾ ਸਹੀ ਤਰੀਕਾ ਉੱਠਣ ਬੈਠਣ ਦਾ ਸਹੀ ਤਰੀਕਾ ਅਤੇ ਉਸਦੇ ਪਹਿਰਾਵੇ ਦਾ ਸਹੀ ਤਰੀਕਾ ਹੋਰ ਵੀ ਬਹੁਤ ਸਿੱਖਿਅਤ ਵਿ ਵਿਅਕਤੀ ਵਿੱਚ ਚੰਗੇ ਵਿਅਕਤੀ ਵਿੱਚ ਗੱਲਾਂ ਨੇ ਜਿਹੜੀਆਂ ਉਹਦੇ ਸੁਭਾਅ 'ਤੇ ਨਿਰਭਰ ਕਰਦੀਆਂ ਨੇ ਵਿਵਹਾਰ ਅਤੇ ਸਿਧਾਂਤ ਉਹਦੀ ਬੇਸਿਕ ਸਟੈਂਡ ਜਿੱਦਾਂ ਨੌਲੇਜ ਜਾਂ ਸਟੱਡੀ ਉਹਦੇ ਤੋਂ ਹੀ ਬਣਦਾ ਉਹਦਾ ਉੱਠਣ ਬੈਠਣ ਦਾ ਸਹੀ ਤੌਰ ਤਰੀਕੇ ਨੂੰ ਦੇਖ ਕੇ ਹੀ ਬੰਦੇ ਦੀ ਪਛਾਣ ਕੀਤੀ ਜਾ ਸਕਦੀ ਹੈ